ਕਿਸਾਨ ਦੇ ਖੁਦਕੁਸ਼ੀ ਖੁਦਕੁਸ਼ੀ ਦੇ ਕਾਰਣ ਠੀਕ ਹੈ ਜੀ ਇੱਕ ਤਾਂ ਵਾਹੁਣ ਲੈਂਦਾ ਮਤਲਬ ਕਿ ਠੇਕੇ 'ਤੇ ਉਹ ਫ਼ਸਲ ਵਗੈਰਾ ਉਗਾਉਂਦਾ ਜੀ ਉਹਦੇ ਵਿੱਚ ਕੀ ਹੁੰਦਾ ਮਤਲਬ ਕੇ ਵੀ ਫ਼ਸਲ 'ਤੇ ਜਦੋਂ ਮਾਰ ਪੈਂਦੀ ਹੈ ਜੀ ਕੁਦਰਤੀ ਜਿਵੇਂ ਗੜੇ ਵਗੈਰਾ ਇਸ ਤਰ੍ਹਾਂ ਪੈ ਜਾਂਦੇ ਹੈ ਅਤੇ ਫ਼ਸਲ ਦਾ ਨੁਕਸਾਨ ਹੋ ਜਾਂਦਾ ਜੀ ਇੱਕ ਤਾਂ ਉਹ ਨੁਕਸਾਨ ਹੋ ਜਾਂਦਾ ਜੀ ਇੱਕ ਤਾਂ ਇਹਦਾ ਕਾਰਣ ਜੀ ਅਤੇ ਦੂਜਾ ਕਾਰਣ ਹੋ ਗਿਆ ਜੀ ਮਤਲਬ ਕੇ ਵਾਹੀ ਦੇ ਵਾਹੁਣ ਖਾਤਰ ਇਹਨੂੰ ਮਤਲਬ ਕੇ ਜੀ ਸੰਦ ਵਗੈਰਾ ਵੀ ਚਾਹੀਦੇ ਹੁੰਦੇ ਆ ਜਿਵੇਂ ਟਰੈਕਟਰ ਹੋ ਗਿਆ ਹਲ਼ ਹੋ ਗਿਆ ਇਸ ਤਰ੍ਹਾਂ ਅਤੇ ਉਹ ਸਾਰੇ ਸੰਦ ਮਤਲਬ ਕੇ ਵੀ ਉਹ ਲੈਂਦਾ ਜੀ ਠੀਕ ਹੈ ਜੀ ਅਗਲਾ ਕਰਜ਼ਾ ਚੁੱਕ ਕੇ ਹੀ ਲੈਂਦਾ ਜੀ ਠੀਕ ਹੈ ਜੀ ਉਹਦਾ ਕਰਕੇ ਇੱਕ ਕਾਰਣ ਇਹਦਾ ਹੁਣ ਹੋ ਜਾਂਦਾ ਹੈ ਅਤੇ ਇਹਦਾ ਕਾਰਣ ਮਤਲਬ ਕੇ ਵੀ ਫ਼ਸਲ 'ਤੇ ਨਿਰਭਰ ਹੁੰਦਾ ਜੀ ਉਹ 'ਤੇ ਮਤਲਬ ਕੇ ਫ਼ਸਲ 'ਤੇ ਹੀ ਨਿਰਭਰ ਹੋ ਕੇ ਅਤੇ ਉਹਦੇ ਵਿੱਚੋਂ ਮਤਲਬ ਵੀ ਕਿਸਾਨ ਨੇ ਮਤਲਬ ਜਿਹਦਾ ਦੇਣਾ ਲੈਣਾ ਹੁੰਦਾ ਜੀ ਉਹ ਮੋੜਨਾ ਹੁੰਦਾ ਠੀਕ ਹੈ ਜੀ ਅਤੇ ਖੁਦਕੁਸ਼ੀ ਦਾ ਜੀ ਇਹ ਕਾਰਣ ਹੁੰਦਾ ਜੀ ਅਤੇ ਸ ਸਰਕਾਰ ਨੂੰ ਚਾਹੀਦਾ ਮਤਲਬ ਕੇ ਵੀ ਇਹਦੇ ਵਿੱਚ ਵੀ ਇਹਨਾਂ ਨੂੰ ਮਤਲਬ ਮੁਆਵਜ਼ਾ ਦੇਣਾ ਚਾਹੀਦਾ ਜੀ ਠੀਕ ਹੈ ਜੀ ਖੇਤੀ ਦਾ ਜਿਵੇਂ ਨੁਕਸਾਨ ਹੁੰਦਾ ਜੀ ਇਹਦੇ ਵਿੱਚ ਅਤੇ ਜਿਵੇਂ ਟਰੈਕਟਰ ਦਾ ਹੁੰਦਾ ਵੀ ਟਰੈਕਟਰ ਮਤਲਬ ਸੰਦ ਕਿਹੜੇ ਮਤਲਬ ਵੀ ਘੱਟ ਤੋਂ ਘੱਟ ਮਤਲਬ ਵੀ ਜਿਵੇਂ ਕਿਰਾਏ 'ਤੇ ਲਾ ਲਓ ਸਰਕਾਰ ਨੂੰ ਦੇਣੇ ਚਾਹੀਦੇ ਜਾਂ ਸਬਸਿਡੀ 'ਤੇ ਇੱਦਾਂ ਦਾ ਕੋਈ ਰੂਲ ਕੱਢਿਆ ਜਾਵੇ ਜੀ ਯਾਨੀ ਕੇ ਜਿਹਦੇ ਨਾਲ ਕਿਸਾਨ ਵੀ ਬਹੁਤ ਚੰਗੇ ਢੰਗ ਨਾਲ ਵੀ ਖੇਤੀ ਕਰ ਸਕੇ ਇੱਕ ਤਾਂ ਬਹੁਤ ਘੱਟ ਤੋਂ ਘੱਟ ਖ਼ਰਚੇ ਨਾ ਹੋਵੇ ਠੀਕ ਹੈ ਕਿਸਾਨ ਦਾ ਅਤੇ ਵਧੀਆ ਤਰੀਕੇ ਨਾਲ ਮਤਲਬ ਕੇ ਵੀ ਖੇਤੀ ਕਰ ਸਕੇ ਅਤੇ ਧੰਨਵਾਦ ਜੀ ਥੈਂਕ ਯੂ ਜੀ